ਕਈ ਤਰੀਕੇ ਹਨ ਜਿਸ ਜਿੰਨ੍ਹਾਂ ਨਾਲ ਖੇਡਾਂ ਲੋਕਾਂ ਦੇ ਜੀਵਨ ਦੀ ਸਮੁੱਚੀ ਗੁਣਵਤਾ 'ਤੇ ਪੋਜੀਟਿਵ ਪ੍ਰਭਾਵ ਪਾ ਸਕਦੀਆਂ ਹਨ ਜੇ ਜਿੱਦਾਂ ਕਿ ਪੜ੍ਹ ਲਿਖ ਕੇ ਜਿਹੜੇ ਲੋਕ ਬੋਲਦੇ ਸੀ ਕਿ ਪੜ੍ਹ ਲਿਖ ਕੇ ਚੰਗੇ ਬਣਦੇ ਹਨ ਲੋਕ ਉਹ ਵੀ ਗਲਤ ਹੋ ਗਏ ਹਨ ਕਿਉਂਕਿ ਜਿਹੜੇ ਲੋਕ ਖੇਡਾਂ ਵਿੱਚ ਅੱਵਲ ਹੁੰਦੇ ਹਨ ਉਹ ਖੇਡਾਂ ਵਿੱਚ ਹੀ ਅੱਵਲ ਹੁੰਦੇ ਹਨ ਅਤੇ ਹੋਰ ਵੀ ਕਈ ਤਰੀਕੇ ਹਨ ਜਿੱਦਾਂ ਜਿਹੜੇ ਲੋਕ ਅੱਛੇ ਤੋਂ ਅੱਛੇ ਖੇਡ ਲੈਂਦੇ ਹਨ ਉਹ ਬਾਅਦ ਵਿੱਚ ਵੀ ਅੱਛੇ ਤੋਂ ਅੱਛੇ ਹੀ ਖੇਡਦੇ ਹਨ ਅਤੇ ਜਿਹੜੇ ਲੋਕ ਬੁਰੇ ਤੋਂ ਬੁਰਾ ਖੇਡਦੇ ਹਨ ਉਹ ਕੁਛ ਵੀ ਨਹੀਂ ਕਰ ਸਕਦੇ ਜਿਹੜੇ ਲੋਕ ਪੜ੍ਹਦੇ ਹਨ ਉਹ ਖੇਡ ਵੀ ਲੈਂਦੇ ਹਨ ਅਤੇ ਸਾਰੇ ਕੰਮਾਂ ਵਿੱਚ ਅੱਵਲ ਹੁੰਦੇ ਹਨ ਅਤੇ ਜਿਹੜੇ ਲੋਕ ਨਾ ਹੀ ਪੜ੍ਹਦੇ ਹਨ ਅਤੇ ਨਾ ਹੀ ਖੇਡਦੇ ਹਨ ਬਸ ਅਵਾਰਾ ਹੀ ਫਿਰਦੇ ਰਹਿੰਦੇ ਹਨ ਅਤੇ ਹੋਰ ਵੀ ਕਈ ਤਰੀਕੇ ਹਨ ਜਿੰਨ੍ਹਾਂ ਨਾਲ ਖੇਡਾਂ ਲੋਕਾਂ ਦੇ ਜੀਵਨ ਦੀ ਸਮੁੱਚੀ ਗੁਣਵਤਾ ਤੋਂ ਪੋਜੀਟਿਵ ਪ੍ਰਭਾਵ ਪਾ ਸਕਦੀਆਂ ਹਨ